ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਕਪੂਰਥਲਾ ਗੈਸ ਅਜੈਂਸੀ ਇੰਡੀਕਾ ਤੋਂ ਇੰਡੀਕਾ ਤੋਂ ਬੋਲਦੇ ਹੋ ਹਾਂਜੀ ਮੈਮ ਐਕਚੁਲੀ ਨਾ ਮੇਰਾ ਸਿਲੰਡਰ ਰਾਤੀਂ ਮੈਂ ਖਾਣਾ ਪਕਾ ਰਿਹਾ ਸੀ ਮਤਲਬ ਖਤਮ ਹੋ ਗਿਆ ਹਾਂਜੀ ਮਹੀਨੇ ਦੇ ਜਿਹੜੇ ਉਪਲਬਧ ਹੁੰਦੇ ਆ ਚਾਰ ਸਿਲੰਡਰ ਉਨ੍ਹਾਂ 'ਚੋਂ ਮੇਰਾ ਕੋਟਾ ਪਿਆ ਹੈ ਜੀ ਹਾਲੇ ਦੋ ਸਿਲੰਡਰ ਮੇਰੇ ਰਹਿੰਦੇ ਹੈ ਹਾਂਜੀ ਮੈਮ ਮੈਂ ਸਿਲੰਡਰ ਬੁੱਕ ਕਰਵਾਉਣਾ ਸੀਗਾ ਹਾਂਜੀ ਮੇਰਾ ਕਾਪੀ ਨੰਬਰ ਹੈਗਾ ਜੀ ਏ ਬੀ ਸੀ ਟੂ ਟ੍ਰਿਪਲ ਜੀਰੋ ਥ੍ਰੀ ਵਨ ਹਾਂਜੀ ਮੈਮ ਹਾਂਜੀ ਮੈਮ ਸਵੇਰੇ ਮੈਮ ਮੈਨੂੰ ਮਿਲ ਸਕਦਾ ਐਕਚੁਲੀ ਮੈਨੂੰ ਜ਼ਰੂਰੀ ਸੀਗਾ ਘਰ ਔਖੀ ਹੋਈ ਪਈ ਹੈ ਸਿਲੰਡਰ ਤੋਂ ਬਿਨਾ ਹਾਂਜੀ ਠੀਕ ਹੈ ਜੀ ਮੈਮ ਮੇਰਾ ਪਤਾ ਹੈਗਾ ਹੈ ਨਵੀਂ ਮੰਡੀ ਭਗਤ ਸਿੰਘ ਚੌਂਕ ਕਪੂਰਥਲਾ ਜੀ ਹਾਂਜੀ ਠੀਕ ਹੈੈੈੈੈੈੈੈੈ ਜੀ ਮੈਮ ਉਨ੍ਹਾਂ ਨੂੰ ਇਹ ਮੈਸਿਜ ਦਿਖਾਉਣਾ ਪਵੇਗਾ ਜੋ ਤੁਸੀਂ ਸੈਂਡ ਕਰੋਂਗੇ ਹਾਂਜੀ ਠੀਕ ਹੈ ਜੀ ਓਕੇ ਜੀ